ਹੈਲੋ ਸਤਿ ਸ਼੍ਰੀ ਅਕਾਲ ਮੈਮ ਵਧੀਆ ਵਧੀਆ ਜੀ ਠੀਕ ਹੋ ਜੀ ਤੁਸੀਂ ਹਾਂਜੀ ਮੈਮ ਆਪਾਂ ਬੱਚਾ ਆਪਾਂ ਸਕੂਲ ਲਾਉਣਾ ਸੀ ਸਕੂਲ ਬਾਰੇ ਪੁੱਛਣਾ ਸੀ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਵਧੀਆ ਸਕੂਲ ਕਿਹੜਾ ਹੈਗਾ ਠੀਕ ਹੈ ਠੀਕ ਹੈ ਜੀ

ਠੀਕ ਹੈ ਓਕੇ ਓਕੇ ਊਂ ਸਾਰਾ ਟੋਟਲ ਸਟਾਫ਼ ਕਿੱਥੋਂ ਦਾ ਹੁੰਦਾ ਜੀ ਇਹਨਾਂ ਦਾ ਓਕੇ ਓਕੇ ਓਕੇ ਓਕੇ ਬੱਚੇ ਦਾ ਆਪਾਂ ਪ੍ਰੀ ਸਕੂਲ ਤੋਂ ਸਟਾਟ ਕਰਨਾ ਆਪਾਂ ਸਟਾਟਿੰਗ ਤੋਂ ਹੀ ਜੀ ਅਤੇ ਫੀਸ ਵਗੈਰਾ ਪਤਾ ਜੀ ਕੁਛ ਕੀ ਰਹਿ ਜਾਂਦੀ ਆ ਉਨ੍ਹਾਂ ਦੀ ਠੀਕ ਹੈ ਜੀ ਮਾ ਮਾ ਬਾਕੀ ਮੰਥਲੀ ਫੀਸ ਜਾਂਦੀ ਆ ਹੈਂਅ ਜੀ ਓਕੇ ਓਕੇ ਠੀਕ ਹੈ ਫਸਟ ਫਸਟ ਟੈਮ ਆਪਾਂ ਪੰਜ ਹਜ਼ਾਰ ਰੁਪਇਆ ਭਰਨਾ ਉਸ ਤੋਂ ਬਾਅਦ ਕੁਆਟਰ ਠੀਕ ਹੈ ਠੀਕ ਹੈ ਜੀ ਅਤੇ ਆਪਣਾ ਬੋ ਇਸ ਸਕੂਲ ਦਾ ਬੋਡ ਕਿੱਥੋਂ ਦਾ ਜੀ ਠੀਕ ਹੈ ਸੀ ਬੀ ਐੱਸ ਈ ਬੋਡ ਦਾ ਜੀ ਵਧੀਆ ਬੱਚਾ ਵਧ ਵਧੀਆ ਬੱਚੇ ਨੂੰ ਫੈਸਿਲਿਟੀਆਂ ਵਧੀਆ ਮਿਲਦੀਆਂ ਨੇ ਸਕੂਲ 'ਚ

ਹਾਂਜੀ ਹਾਂਜੀ ਇਹ ਵੀ ਆਪਣਾ ਬੱਚਾ ਸਟਾਟਿੰਗ ਤੋਂ ਬੱਚੇ ਨੂੰ ਵਧੀਆ ਐਨਵਾਇਰਮੈਂਟ ਮਿਲੇ ਵਧੀਆ ਸਿੱਖਣ ਨੂੰ ਹੈ ਖੇਡਣ ਨੂੰ ਵੀ ਪੜ੍ਹਨ ਨੂੰ ਵੀ ਵਧੀਆ ਐਨਵਾਇਰਮੈਂਟ ਮਿਲੇ ਉਨ੍ਹਾਂ ਨੂੰ ਅਤੇ ਹਾਂਜੀ ਹਾਂਜੀ ਮੈਂ ਕਈਆਂ ਤੋਂ ਪਤਾ ਕੀਤਾ ਸੀਗਾ ਵੀ ਸਕੂਲ ਬਰਨਾਲੇ 'ਚ ਹੋਰ ਵੀ ਨੇ ਪਰ ਮੈਨੂੰ ਪ ਵਧੀਆ ਨਹੀਂ ਲੱਗੇ ਜੀ ਇੱਥੇ ਸਕੂਲ 'ਚ ਸਟਾਫ਼ ਵੀ ਜਿਆਦ ਜ਼ਿਆਦਾਤਰ ਲੋਕਲ ਸੀਗਾ ਕਿਸੇ ਦੀ ਗ੍ਰੈਜੂਏਸ਼ਨ ਕੀਤੀ ਹੋਈ ਸੀ ਕਿਸੇ ਦੀ ਐੱਮ ਏ ਕੀਤੀ ਹੋਈ ਸੀਗੀ ਵੀ ਜ਼ਿਆਦਾ ਪੜ੍ਹੇ ਲਿਖੇ ਲੱਗਦੇ ਨਹੀਂ ਸੀਗੇ ਵੀ ਜਦੋਂ ਹੁਣ ਆਪ ਹੀ ਨਹੀਂ ਹੈਗੀ ਥੋੜ੍ਹੀ ਜਿਹੀ ਸੈਂਸ ਉਹਨਾਂ ਨੂੰ ਫੇਰ ਬੱਚੇ ਨੂੰ ਆਪਣੇ ਨੂੰ ਕੀ ਸਿਖਾਉਣਗੇ ਗੱਲ ਠੀਕ ਹੈ ਠੀਕ ਹੈ ਜੀ ਓਕੇ ਓਕੇ ਪਹਿਲਾਂ ਪੇਰੈਂਟਸ ਨੂੰ ਦੇਖਦੇ ਹੈ ਵੀ ਇਹ ਬੱਚੇ ਨੂੰ ਵੀ ਸਿੱਖਿਆ ਦੇਣ ਦੇ ਕਾਬਲ ਹੈ ਹਾਂਜੀ ਹਾਂਜੀ ਆਪਾਂ ਵੈਸੇ ਤਾਂ ਆਪਾਂ ਬੱਚੇ ਦੀ ਨਾਲ ਨਾਲ ਟੂਸ਼ਨ ਵੀ ਰੱਖ ਸਕਦੇ ਹੈਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਦੇਖਦੇ ਹੈ ਫੇਰ ਠੀਕ ਹੈ ਠੀਕ ਹੈ ਫੇਰ ਮੋਰਨਿੰਗ ਅਸੀਂ ਟਰਾਈ ਕਰਦੇ ਉੱਥੇ ਜਾ ਕੇ ਆਵਾਂਗੇ ਸਕੂਲ ਦੇ ਵਿੱਚ ਠੀਕ ਹੈ ਠੀਕ ਹੈ ਜੀ ਥੈਂਕ ਯੂ ਮੈਮ ਥੈਂਕ ਯੂ ਸਤਿ ਸ਼੍ਰੀ ਅਕਾਲ